ਸਤਿ ਸ਼੍ਰੀ ਅਕਾਲ ਮੈਂ ਸਿੱਖ ਧਰਮ ਤੋਂ ਹਾਂ ਅਤੇ ਮੈਂ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਰਹਿੰਦਾ ਹਾਂ ਇੱਥੇ ਗੁ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕੋ ਹੀ ਸ ਸਮਝਿਆ ਜਾਂਦਾ ਹੈ ਮੈਂ ਗੱਲ ਕਰਦਾ ਹਾਂ ਕਿ ਸਾਡੇ ਗੁਰੂ ਦਾ ਗੁਰਦੁਆਰਾ ਜਿਹੜਾ ਦਰਬਾਰ ਸਾਹਿਬ ਹੈ ਇੱਥੇ ਚਾਰ ਦਰਵਾਜ਼ੇ ਹਨ ਜਿ ਜਿਹਦਾ ਉਦੇਸ਼ ਹੈ ਕਿ ਚਾਰੋਂ ਦਿਸ਼ਾਵਾਂ ਦੇ ਲੋਕ ਕੋਈ ਵੀ ਧਰਮ ਦਾ ਹੋਵੇ ਇੱਥੇ ਆ ਸਕਦਾ ਹੈ ਅਤੇ ਸਾਡੀ ਵ ਵਕਸ਼ਿਪ ਦਾ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ਕਿ ਅਸੀਂ ਹਰ ਇੱਕ ਇਨਸਾਨ ਨੂੰ ਲ ਲੰਗਰ ਛਕਾਉਂਦੇ ਹਾਂ ਅਤੇ ਇੱਕ ਓਂਕਾਰ ਸਤਿਨਾਮ ਦਾ ਨਾ ਨਾਰਾ ਲਗਾਉਂਦੇ ਹਾਂ ਇਸ ਦਾ ਮਤਲਬ ਹੈ ਕੀ ਭ ਭਗਵਾਨ ਦਾ ਕੋਈ ਆਕਾਰ ਨਹੀਂ ਹੈ ਅਤੇ ਉਹ ਨਾਮ ਸਤਿਨਾਮ ਹੀ ਇਕ ਸੱਚਾ ਨਾਮ ਹੈ ਇਸ ਤੋਂ ਇਲਾਵਾ ਸਾਡਾ ਡੀਫੋ ਡੀਵੋਸ਼ਨ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ਕੀ ਅਸੀਂ ਇ ਗੁਰਬਾਣੀ ਦਾ ਪਾਠ ਕਰਦੇ ਹਾਂ ਅਤੇ ਮ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਪਾਠ ਰੱਖ ਕੇ ਸਾਰੇ ਦੁਨੀਆਂ ਦੇ ਭਲੇ ਲਈ ਆਪਾਂ ਅਰਦਾਸ ਕਰਦੇ ਹਾਂ ਕਮਿਟਮੈਂਟ ਵਿੱਚ ਆਪਾਂ ਇਸ ਤਰੀਕੇ ਨਾਲ ਦੱਸ ਸਕਦੇ ਹਾਂ ਕਿ ਕ ਸਾਡੀ ਕਮਿਟਮੈਂਟ ਇਹ ਹੁੰਦੀ ਹੈ ਕਿ ਆਪਾਂ ਕਿਸੇ ਵੀ ਧਰਮ ਦੇ ਲੋਕ ਨਾਲ ਭੇਦ ਭਾਵ ਨਾ ਕਰੀਏ ਸਾਡੇ ਗੁਰੂ ਨਾਨਕ ਦੇਵ ਜੀ ਨੇ ਤੇਰੀ ਤੇਰੀ ਕਰਕੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਜਿਸ ਵਿੱਚ ਅਮੀਰ ਗਰੀਬ ਦਾ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਸਾਰੇ ਲੋਕ ਇਕੱਠੇ ਬਹਿ ਕੇ ਇੱਕੋ ਹੀ ਪੰਗਤ ਵਿੱਚ ਲੰਗਰ ਕਰਦੇ ਹਨ ਜਿਸ ਨਾਲ ਸਾਡੇ ਧਰਮ ਬਾਰੇ ਆਪਾਂ ਸਭ ਕੁਝ ਜਾਣ ਸਕਦੇ ਹਾਂ